ਪੰਜਾਬ ਦੇ ਵਿੱਚ ਬਹੁਤ ਸਾਰੇ ਕਹਾਵਤਾਂ ਅਤੇ ਮੁਹਾਵਰੇ ਹੈ ਜਿਵੇਂ ਕੁਛ ਲੋਕ ਇਹੋ ਜਿਹੇ ਹੁੰਦੇ ਆ ਉਹ ਹਰ ਥਾਂ ਦੇ ਉੱਤੇ ਹਾਜ਼ਰ ਹੁੰਦੇ ਹੈ ਅਤੇ ਉਹਨਾਂ ਬਾਰੇ ਇੱਕ ਕਹਾਵਤ ਹੈ ਮੁਹਾਵਰਾ ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜ੍ਹੀ ਤਾਂ ਉਸ ਬੰਦੇ ਬਾਰੇ ਕਿਹਾ ਜਾਂਦਾ ਜਿਹੜਾ ਬੰਦਾ ਹਰ ਥਾਂ ਦੇ ਉੱਤੇ ਹਾਜ਼ਰ ਹੋਵੇ ਹਰ ਗੱਲ ਦੇ ਵਿੱਚ ਦਖਲ ਦੇਵੇ ਇਸ ਤਰ੍ਹਾਂ ਬਹੁਤ ਸਾਰੇ ਲੋਕ ਹੈ ਜਿਹੜੇ ਉਸ ਸਮੇਂ ਸਮੇਂ 'ਤੇ ਜਾ ਕੇ ਬਦਲ ਜਾਂਦੇ ਹੈ ਅਤੇ ਉਹਨਾਂ ਬਾਰੇ ਇਹ ਮੁਹਾਵਰਾ ਮਸ਼ਹੂਰ ਹੈ ਕਿ ਗੰਗਾ ਗਏ ਦਾ ਗੰਗਾ ਰਾਮ ਯਮੁਨਾ ਦਾ ਯਮੁਨਾ ਦਾਸ ਯਾਨੀ ਉਹ ਜਿੱਥੇ ਵੀ ਜਾਂਦੇ ਹੈ ਉਹਨਾਂ ਦੇ ਵਰਗੇ ਹੀ ਹੋ ਜਾਂਦੇ ਹੈ ਉਹਨਾਂ ਦੇ ਨਾਲ ਹੀ ਮਿਲ ਜਾਂਦੇ ਹੈਗੇ ਹੈ ਅਤੇ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਕਹਾਵਤਾਂ ਅਤੇ ਮੁਹਾਵਰੇ ਵੀ ਹੈਗੇ ਹੈ ਜਿਵੇਂ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਵੀ ਪੰਚਾਂ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਜਦੋਂ ਵੀ ਸਾਨੂੰ ਕੋਈ ਸਿਆਣਾ ਬੰਦਾ ਕੋਈ ਆਪਣੇ ਤੋਂ ਵੱਡਾ ਕੋਈ ਗੱਲ ਕਹਿੰਦਾ ਅਤੇ ਅਸੀਂ ਕਹਿ ਦਿੰਦੇ ਹਾਂ ਵੀ ਹਾਂ ਜੀ ਠੀਕ ਹੈ ਜੀ ਜਿਵੇਂ ਆਪਾਂ ਆਪਣੇ ਬੱਚੇ ਨੂੰ ਕਹਿ ਦਈਏ ਵੀ ਉੱਠਿਆ ਕਰੋ ਜਲਦੀ ਨਹੀਂ ਉੱਠਦਾ ਪਰ ਪਰ ਉਹ ਕਹਿ ਦਿੰਦਾ ਹਾਂ ਮੈਂ ਉਠੂੰਗਾ ਤਾਂ ਉਸ ਤਰ੍ਹਾਂ ਪੰਚਾਂ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਯਾਨੀ ਕਰਨੀ ਉਹਨਾਂ ਨੇ ਆਪਣੀ ਮਨ ਮਰਜ਼ੀ ਹੁੰਦੀ ਹੈ ਪਰ ਉਹ ਇੱਕ ਵਾਰ ਹਾਂ ਭਰ ਦਿੰਦੇ ਆ ਅਤੇ ਇਸ ਜਿਹੜਾ ਇਹ ਮਤਲਬ ਮੁਹਾਵਰਾ ਇਹ ਉਹਨਾਂ ਦੇ ਉੱਤੇ ਪੂਰਾ ਢੁੱਕਦਾ ਹੈਗਾ